ਪੁਰਾਣੇ ਸਮੇਂ ਦੇ ਸਿੱਕੇ ਜੋ ਕਿ ਬਹੁਤ ਕੀਮਤੀ ਹਨ ਮੇਰੇ ਕੋਲ ਤਿੰਨ ਪੁਰਾਣੇ ਸਿੱਕੇ ਹਨ ਜੋ ਕਿ ਸੌ ਸਾਲ ਪੁਰਾਣੇ ਹਨ ਮੈਨੂੰ ਮੇਰੇ ਦਾਦਾ ਜੀ ਨੇ ਦਿੱਤੇ ਸੀ ਉਹਨਾਂ ਦੀ ਕੋਈ ਕੀਮਤ ਨਹੀਂ ਹੈ ਉਹ ਅਨਮੋਲ ਹਨ ਮੈਂ ਉਹਨਾਂ ਨੂੰ ਕਦੇ ਵੀ ਦੇਣਾ ਨਹੀਂ ਚਾਹੁੰਦਾ